ਮੈਂ ਆਪਣੀ ਸਿਖਲਾਈ ਅਤੇ ਦੌੜ ਦੀ ਤਿਆਰੀ ਵਿੱਚ ਪੋਸ਼ਨ ਅਤੇ ਹਾਈਡਰੇਸ਼ਨ ਨੂੰ ਚੰਗੀ ਤਰ੍ਹਾਂ ਮੇਨਟੇਨ ਰੱਖਦੀ ਹਾਂ ਇਸ ਵਿੱਚ ਮੈਂ ਸਵੇਰੇ ਦੌੜ ਕਰਨ ਜਾਂਦੀ ਹਾਂ ਰਨਿੰਗ ਕਰਦੀ ਹਾਂ ਅਤੇ ਸ਼ਾਮ ਨੂੰ ਯੋਗਾ ਕਰਦੀ ਹਾਂ ਅਤੇ ਆਪਣਾ ਫਲ ਫਰੂਟ ਖਾਂਦੀ ਹਾਂ ਆਪਣੀ ਡਾਇਟ ਫੋਲੋ ਕਰਦੀ ਹਾਂ ਮੈਂ ਦਿਨ ਵਿੱਚ ਦੋ ਤਿੰਨ ਲੀਟਰ ਪਾਣੀ ਪੀਣਾ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਰਨਿੰਗ ਕਰਦੀ ਹਾਂ ਸਵੇਰੇ ਜਦੋਂ ਜਾਂਦੀ ਹਾਂ ਤਾਂ ਮੈਂ ਰਨਿੰਗ ਕਰਦੀ ਹਾਂ ਫਿਰ ਆਉਣ ਜਦੋਂ ਆਉਂਦੀ ਹਾਂ ਤਾਂ ਮੈਂ ਫਿਰ ਪਾਣੀ ਪੀਂਦੀ ਹਾਂ ਫਿਰ ਪਾਣੀ ਪੀ ਕੇ ਮੈਂ ਦੁੱਧ ਪੀਂਦੀ ਹਾਂ ਪਾਣੀ ਪੀਣ ਤੋਂ ਬਾਅਦ ਜਦੋਂ ਦੁੱਧ ਪੀਂਦੀ ਹਾਂ ਤਾਂ ਮੈਂ ਯੋਗਾ ਵੀ ਕਰਦੀ ਹਾਂ ਯੋਗਾ ਕਰਦੀ ਹਾਂ ਸ਼ਾਮ ਨੂੰ ਵੀ ਯੋਗਾ ਕਰਦੀ ਹਾਂ ਅਤੇ ਹਾਈਡਰੇਸ਼ਨ ਦੀ ਕਮੀ ਲਈ ਹਾਈਡਰੇਸ਼ਨ ਦੀ ਕਮੀ ਵਾਸਤੇ ਮੈਂ ਦੋ ਤਿੰਨ ਲੀਟਰ ਦਿਨ ਵਿੱਚ ਪਾਣੀ ਪੀਂਦੀ ਹਾਂ ਅਤੇ ਮੈਨੂੰ ਮੈਨੂੰ ਬਹੁਤ ਜ਼ਿਆਦਾ ਹੀ ਚੰਗਾ ਫੀਲ ਹੁੰਦਾ ਕਿ ਮੇਰਾ ਸਰੀਰ ਬਿਲਕੁਲ ਮੇਨਟੇਨ ਹੈ ਮੈਂ ਡਾਇਟ ਫੋਲੋ ਕਰਦੀ ਹਾਂ ਡਾਇਟ ਵਿੱਚ ਮੈਂ ਫਲ ਫਰੂਟ ਖਾਂਦੀ ਹਾਂ ਅਤੇ ਜਿੱਦਾਂ ਕਿ ਮਖਾਣੇ ਛੋਲੇ ਬਨਾਨਾ ਐਪਲ ਇਸ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਤਲੀਆਂ ਫਲੀਆਂ ਚੀਜ਼ਾਂ ਬਿਲਕੁਲ ਬੰਦ ਨੇਗੇ ਮੈਂ ਤਲੀ ਫਲੀ ਚੀਜ਼ ਕੁਛ ਵੀ ਨਹੀਂ ਖਾਣੀ ਹੈਗੀ ਡਾਇਟ ਨੂੰ ਮੇਨਟੇਨ ਰੱਖਦੀ ਹਾਂ ਹਾਈਡਰੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਪਾਣੀ ਆਪਣਾ ਪੂਰਾ ਮੇਨਟੇਨ ਹੁੰਦਾ ਮੇਰਾ ਦੌੜਦੀ ਚੰਗੀ ਤਰ੍ਹਾਂ ਰਨਿੰਗ ਹੁੰਦੀ ਹੈ ਮੇਰੇ ਤੋਂ ਕੋਈ ਸਾਹ ਸੂ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਗਾ ਅਤੇ ਸ਼ਾਮ ਨੂੰ ਯੋਗਾ ਕਰਦੀ ਹਾਂ ਸਵੇਰ ਵੇਲੇ ਰਨਿੰਗ ਕਰਨ ਜਾਂਦੀ ਹੈਗੀ ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਨਹੀਂ ਸਰੀਰ ਮੇਰਾ ਬਿਲਕੁਲ ਚੰਗੀ ਤਰ੍ਹਾਂ ਮੇਨਟੇਨ ਰਹਿੰਦਾ ਗਾ ਕੋਈ ਵੀ ਚੱਲਣ 'ਚ ਨਹੀਂ ਪ੍ਰੋਬਲਮ ਆਉਂਦੀ ਕੋਈ ਸਾਹ ਨਹੀਂ ਚੜ੍ਹਦਾ ਮੈਨੂੰ ਤਲੀਆਂ ਫਲੀਆਂ ਚੀਜ਼ਾਂ ਮੈਂ ਬਿਲਕੁਲ ਬੰਦ ਨਹੀਂ ਜਾਂ ਕੁਝ ਖਾਣ ਪੀਣ ਦਾ ਕੋਈ ਉਹ ਨਹੀਂ ਹੈਗਾ ਆਪਣੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ